ਸਿੱਖਿਆ ਇੱਕ ਅਜਿਹੀ ਚੀਜ਼ ਹੈ ਜਿਸ ਤੋਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲਦਾ ਹੈ ਇਸਨੇ ਪੰਜਾਬੀ ਸੱਭਿਆਚਾਰ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਹੈ ਜੇਕਰ ਸਾਡੇ ਕੋਲ ਸਿੱਖਿਆ ਹੋਊਗੀ ਤਾਂ ਅਸੀਂ ਬਹੁ ਦੂਸਰਿਆਂ ਨੂੰ ਬਹੁਤ ਕੁਝ ਸਿਖਾ ਸਕਦੇ ਹਾਂ ਅਤੇ ਉਹਨਾਂ ਦੇ ਵਿੱਚ ਵੀ ਸਿੱਖਿਆ ਦੀ ਭਾਵਨਾ ਨੂੰ ਪੈਦਾ ਕਰ ਸਕਦੇ ਹਾਂ ਸਿੱਖਿਆ ਸਿੱਖਿਆ ਦੇ ਨਾਲ਼ ਪੰ ਪੰਜਾਬੀ ਸੱਭਿਆਚਾਰ ਦੇ ਵਿੱਚ ਸਾਨੂੰ ਸਾਡੇ ਰੀਤੀ ਰਿਵਾਜ ਸਾਡਾ ਰਹਿਣ ਸਹਿਣ ਅਸੀਂ ਕਿੱਦਾਂ ਪਹਿਰਾਵਾ ਪਾਉਣਾ ਹੈ ਇਹਨਾਂ ਸਭ ਬਾਰੇ ਪਤਾ ਲੱਗਦਾ ਹੈ ਜੇਕਰ ਸਾਡੇ ਕੋਲ ਸਿੱਖਿਆ ਈ ਹੀ ਨਹੀਂ ਹੋਊਗੀ ਅਸੀਂ ਕੁਛ ਪੜਾਂਗੇ ਲਿਖਾਂਗੇ ਨਹੀਂ ਤਾਂ ਸਾਨੂੰ ਇਹ ਪਤਾ ਹੀ ਨਹੀਂ ਲੱਗਣਾ ਕਿ ਅਸੀਂ ਕਿੱਦਾਂ ਕਿੱਦਾਂ ਦੇ ਸਮਾਜ ਵਿੱਚ ਰਹਿੰਦੇ ਹਾਂ ਸਾਡਾ ਸਮਾਜ ਕਿੱਦਾਂ ਦਾ ਹੈ ਅਸੀਂ ਕਿੱਦਾਂ ਆਪਣੇ ਨਾਲ ਆਪਸੀ ਮੇਲ ਮਿਲਾਪ ਕਰਨਾ ਹੈ ਕਿੱਦਾਂ ਕਿਸੇ ਦੇ ਨਾਲ ਗੱਲਬਾਤ ਕਰਨੀ ਹੈ ਸਾਨੂੰ ਇਹਨਾਂ ਦੇ ਬਾਰੇ ਵਿੱਚ ਕੁਛ ਨਹੀਂ ਪਤਾ ਲੱਗੇਗਾ ਜੇਕਰ ਅਸੀਂ ਇਹਨਾਂ ਬਾਰੇ ਜੇਕਰ ਅਸੀਂ ਪੜਾਂਗੇ ਲਿਖਾਂਗੇ ਤਾਂ ਸਾਨੂੰ ਇਹਨਾਂ ਸਭ ਚੀਜ਼ਾਂ ਬਾਰੇ ਬਹੁਤ ਸਾਰਾ ਗਿਆਨ ਪ੍ਰਾਪਤ ਹੋਊਗਾ ਅਤੇ ਇਸ ਗਿਆਨ ਦੇ ਥਰੂ ਅਸੀਂ ਦੂਜਿਆਂ ਨੂੰ ਬਹੁਤ ਕੁਝ ਸਿਖਾ ਪਾਵਾਂਗੇ ਤਾਂ ਜੋ ਉਹ ਉਹ ਵੀ ਅੱਗੇ ਤੋਂ ਅੱਗੇ ਅਗਲੀ ਪੀੜੀ ਨੂੰ ਬ ਸਿਖਾ ਸਕਣ ਜਿਹਦੇ ਨਾਲ ਸਿੱਖਿਆ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਸਕੇਗਾ ਅਤੇ ਸਿੱਖਿਆ ਨੂੰ ਇੱਕ ਉੱਚ ਪੱਧਰ ਤੱਕ ਲੈ ਕੇ ਜਾ ਜਾਇਆ ਜਾਊਂਗਾ